ਸਾਡੇ ਪਟਿਆਲਾ ਦੇ ਵਿੱਚ ਬਹੁਤ ਸਾਰੇ ਐਜੂਕੇਸ਼ਨਲ ਇੰਸਟੀਟਿਊਟ ਨੇ ਜਿਹੜੇ ਅਲੱਗ ਅਲੱਗ ਤਰ੍ਹਾਂ ਦੀ ਇੱਥੇ ਸਿੱਖਿਆ ਪ੍ਰੋਵਾਈਡ ਕਰਦੇ ਆ ਸਟੂਡੈਂਟਸ ਨੂੰ ਮਤਲਬ ਅਲੱਗ ਅਲੱਗ ਜਗ੍ਹਾ ਤੋਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਸਟੂਡੈਂਟ ਨੇ ਪਟਿਆਲਾ ਦੇ ਵਿੱਚ ਆ ਕੇ ਪੜ੍ਹਦੇ ਨੇ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਥਾਪਰ ਕੋਲੇਜ ਹੋਵੇ ਚਾਹੇ ਖਾਲਸਾ ਕੋਲੇਜ ਹੋਵੇ ਚਾਹੇ ਇੱਥੋਂ ਦੀ ਲੋਅ ਯੂਨੀਵਰਸਿਟੀ ਹੋਵੇ ਰਾਜੀਵ ਗਾਂਧੀ ਲੋਅ ਯੂਨੀਵਰਸਿਟੀ ਅਲੱਗ ਅਲੱਗ ਜਗ੍ਹਾ ਤੋਂ ਆ ਕੇ ਸਟੂਡੈਂਟ ਇੱਥੇ ਪੜ੍ਹਦੇ ਹੈਗੇ ਮਤਲਬ ਇੱਥੇ ਉਹਨਾਂ ਦਾ ਪੜ੍ਹਨ ਦਾ ਹੀ ਇਹ ਹੈਗਾ ਵੀ ਇੱਥੇ ਉਹਨਾਂ ਨੂੰ ਹਰ ਇੱਕ ਤਰੀਕੇ ਦੀ ਜਿਹੜੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੇ ਆਊਟ ਔਫ ਸਟੇਟ ਵੀ ਸਟੂਡੈਂਟ ਪੜ੍ਹਨ ਆਉਂਦੇ ਹੈਗੇ ਉੱਥੇ ਇੰਜੀਨੀਅਰਿੰਗ ਕੋਲੇਜ ਵੀ ਆ ਸਪੋਰਟਸ ਵੀ ਹੈਗਾ ਲੋਅ ਵੀ ਹੈਗਾ ਅਲੱਗ ਅਲੱਗ ਤਰ੍ਹਾਂ ਦੇ ਉੱਥੇ ਜਿਹੜੇ ਕੋਰਸ ਅਵੇਲੇਬਲ ਨੇ ਫਾਈਵ ਈਅਰ ਕੋਰਸ ਸਟਾਰਟ ਹੋਇਆ ਹੈਗਾ ਇਸ ਤਰੀਕੇ ਨਾਲ਼ ਪਟਿਆਲਾ ਦੇ ਵਿੱਚ ਰਾਜੀਵ ਗਾਂ ਰਾਜੀਵ ਗਾਂਧੀ ਲੋਅ ਯੂਨੀਵਰਸਿਟੀ ਹੈਗੀ ਜਿੱਥੇ ਐਡਮਿਸ਼ਨ ਲੈਣਾ ਬਹੁਤ ਹੀ ਔਖਾ ਹੈਗਾ ਉੱਥੋਂ ਦੇ ਜਿਹੜੇ ਸਟੂਡੈਂਟ ਨੇ ਉੱਥੇ ਪੜ੍ਹ ਸਟੱਡੀ ਕਰਨ ਦੇ ਲਈ ਉਹਨਾਂ ਨੂੰ ਇੱਕ ਕੋਰਸ ਕਲੀਅਰ ਕਰਨਾ ਪੈਂਦਾ ਹੈਗਾ ਉਹਨਾਂ ਦਾ ਇੱਕ ਪੇਪਰ ਹੁੰਦਾ ਹੈਗਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਜਾ ਕੇ ਐਡਮਿਸ਼ਨ ਮਿਲਦੀ ਹੈਗੀ ਇਸ ਤਰੀਕੇ ਦੇ ਨਾਲ਼ ਇੱਥੇ ਇੱਕ ਫਿਜ਼ੀਕਲ ਕੋਲੇਜ ਹੈ ਜਿੱਥੋਂ ਦੇ ਸਟੂਡੈਂਟ ਪੂਰੇ ਇੰਡੀਆ ਲੈਵਲ 'ਤੇ ਆਊਟ ਔਫ ਇੰਡੀਆ ਜਾ ਕੇ ਓਲੰਪਿਕ ਦੇ ਵਿੱਚ ਆਪਦਾ ਮਤਲਬ ਜਿਹੜਾ ਉਹ ਖੇਡਾਂ ਦੇ ਵਿੱਚ ਜਾਂਦੇ ਹੈਗੇ ਅਤੇ ਆਪਦੇ ਜਿਹੜੇ ਗੋਲਡ ਮੈਡਲ ਲੈ ਕੇ ਆਉਂਦੇ ਹੈਗੇ ਇਸ ਤਰੀਕੇ ਨਾਲ਼ ਜਿਹੜੀ ਇੱਥੋਂ ਦੀਆਂ ਯੂਨੀਵਰਸਿਟੀਆਂ ਨੇ ਕੋਲੇਜ ਨੇ ਉਹ ਪੂਰੇ ਪਟਿਆਲੇ ਦੇ ਲਈ ਇੱਕ ਆਪਦਾ ਜਿਹੜਾ ਵਿਕਾਸ ਦੇ ਵਿੱਚ ਉਹਨਾਂ ਦਾ ਯੋਗਦਾਨ ਪਾ ਰਹੇ ਨੇ ਔਰ ਸਟੂਡੈਂਟ ਨੇ ਜਿਹੜੇ ਲਗਾਤਾਰ ਇੱਥੋਂ ਬਾਹਰ ਜਾ ਰਹੇ ਨੇ ਆਪਦੀਆਂ ਗੇਮਸ ਦੇ ਗੇਮਸ ਦੇ ਅਕੋਡਿੰਗ ਉਹਨਾਂ ਨੂੰ ਜੋਬਸ ਮਿਲ ਰਹੀਆਂ ਨੇ ਜਾਂ ਇੰਜੀਨੀਅਰਿੰਗ ਦੇ ਤੌਰ 'ਤੇ ਉਹਨਾਂ ਨੂੰ ਜੋਬਸ ਮਿਲ ਰਹੀਆਂ ਨੇ ਇਸ ਤਰੀਕੇ ਨਾਲ਼ ਜਿਹੜੇ ਪਟਿਆਲੇ ਸ਼ਹਿਰ ਦੇ ਲੋਕ ਨੇ ਉਹ ਇੱਥੇ ਆਪਦਾ ਵਿਕਾਸ ਕਰ ਰਹੇ ਨੇ ਅਲੱਗ ਅਲੱਗ ਇੰਸਟੀਟਿਊਟ ਖੁੱਲ੍ਹ ਰਹੇ ਹੈਗੇ ਕੋਚਿੰਗ ਕਲਾਸਿਸ ਲੈ ਰਹੇ ਨੇ ਇਸ ਤਰੀਕੇ ਨਾਲ਼ ਜਿਹੜਾ ਉਹ ਆਪਦਾ ਯੋਗਦਾਨ ਪਾ ਰਹੇ ਹੈਗੇ ਪੂਰੇ ਪਟਿਆਲੇ ਦੇ ਵਿਕਾਸ ਦੇ ਵਿੱਚ